ਜੇ ਭਾਰਤੀ ਰਾਜਨੀਤੀ ਬਾਰੇ ਬਾਈ ਜੀ ਸਾਡੇ ਆਹੀ ਵਿਚਾਰ ਨੇ ਕਿ ਭਾਰਤੀ ਰਾਜਨੀਤੀ ਸਮੇਂ ਸਮੇਂ ਨਾਲ ਬਦਲੀ ਜਾਂਦੀ ਹੈ ਅਤੇ ਮੇਰਾ ਰੁਝਾਨ ਵੀ ਇੰਨਾ ਜ਼ਿਆਦਾ ਭਾਰਤੀ ਰਾਜਨੀਤੀ ਬਾਰੇ ਹੈ ਨੀਗਾ ਕਿਉਂਕਿ ਮੇਰਾ ਇੰਟਰਸਟ ਖੇਡਾਂ ਬਾਰੇ ਜਾਂ ਹੋਰ ਕੰਮਾਂ ਬਾਰੇ ਜ਼ਿਆਦਾ ਹੈ ਅਤੇ ਹਾਂ ਠੀਕ ਆ ਸਮੇਂ ਦੇ ਨਾਲ ਬਹੁਤ ਬਹੁਤ ਬਦਲ ਰਿਹਾ ਯੁੱਗ ਬਦਲ ਰਿਹਾ ਬਹੁਤ ਅੱਗੇ ਨੂੰ ਵੱਧਦਾ ਜਾ ਰਿਹਾ ਸੜਕਾਂ ਡਿਵੈਲਪਮੈਂਟ ਬਹੁਤ ਕੁਛ ਹੋ ਰਿਹਾ ਪਰ ਕਿਤੇ ਨਾ ਕਿਤੇ ਮਾੜਾ ਮੋਟਾ ਕੰਮ 'ਚ ਕੁਤਾਹੀਆਂ ਰਹਿ ਹੀ ਜਾਂਦੀਆਂ ਨੇ ਭ੍ਰਿਸ਼ਟਾਚਾਰ ਹੋ ਗਿਆ ਉਹ ਛੋਟੇ ਮੋਟੇ ਚਲਦੇ ਰਹਿੰਦੇ ਨੇ ਸਰਕਾਰ ਠੀਕ ਆ ਆਪਦੇ ਵਧੀਆ ਕੰਮ ਕਰ ਰਹੀ ਹੈ ਜਿਹੜੀ ਵੀ ਇਹ ਸਰਕਾਰਾਂ ਬਣਦੀਆਂ ਨੇ ਆਪਣੇ ਪੱਖੋਂ ਤਾਂ ਚੰਗੇ ਹੀ ਕਰਦੇ ਨੇ ਪਰ ਇੰਨੀ ਵੱਡੀ ਸਰਕਾਰ ਕਿਸੇ ਸਿਸਟਮ ਨੂੰ ਨਹੀਂ ਸੰਭਾਲ ਸਕਦੀ ਹਾਂਜੀ ਇਸ ਲਈ ਮੇਰਾ ਰਾਜਨੀਤੀ 'ਚ ਕੋਈ ਬਾਹਲਾ ਜ਼ਿਆਦਾ ਤਜ਼ਰਬਾ ਨਹੀਂ ਹੈ ਅਤੇ ਨਾ ਮੇਰਾ ਕੋਈ ਇੰਟਰਸਟ ਆ ਇਸ ਲਈ ਮੈਨੂੰ ਸਭ ਠੀਕ ਠਾਕ ਸਾਰੇ ਠੀਕ ਹੀ ਲੱਗਦੇ ਨੇ ਸਭ ਬਰਾਬਰ ਹੀ ਲੱਗਦੇ ਨੇ